ਅੱਜ ਦੇ ਸਮੇਂ ਵਿੱਚ ਪੰਜਾਬ ਨੇ ਕਾਫ਼ੀ ਤਰੱਕੀ ਕਰ ਲਈ ਹੈ ਅਤੇ ਸਾਡੇ ਖੇਤਰ ਵਿੱਚ ਕਈ ਤਰ੍ਹਾਂ ਦੇ ਸੈਲਾਨੀ ਹਰ ਸ ਵੇਲੇ ਘੁੰਮ ਘੁੰਮਣ ਲਈ ਆਉਂਦੇ ਰਹਿੰਦੇ ਹਨ ਇੱਥੇ ਕਈ ਤਰ੍ਹਾਂ ਦੀਆਂ ਦੇਖਣਯੋਗ ਥਾਵਾਂ ਹਨ ਜਿਸ ਨੂੰ ਕਿ ਸੈਲਾਨੀ ਹਰ ਸਾਲ ਇੱਥੇ ਪੰਜਾਬ ਵਿੱਚ ਆਉਂਦੇ ਹਨ ਅਤੇ ਹੁਣ ਗੱਲ ਕਰੀਏ ਕਿ ਸਾਡੇ ਰਾਜ ਵਿੱਚ ਇਹਨਾਂ ਸੈਲਾਨੀਆਂ ਲਈ ਕੀ ਕੀ ਟਰਾਂਸਪੋਰਟ ਅ ਸਹੂਲਤਾਂ ਅਵੇਲੇਬਲ ਹਨ ਤਾਂ ਪੰਜਾਬ ਵਿੱਚ ਕਈ ਤਰ੍ਹਾਂ ਦੀਆਂ ਸਹੂਲਤਾਂ ਅਤੇ ਟਰਾਂਸਪੋਰਟਾਂ ਅਵੇਲੇਬਲ ਜਿਸ ਨੂੰ ਮੰਨ ਮੰਨ ਕੇ ਚੱਲਿਆ ਜਾਵੇ ਕਿਤੇ ਰਾਜ ਬੱਸਾਂ ਚੱਲਦੀਆਂ ਹਨ ਸਰਕਾਰੀ ਬੱਸਾਂ ਚੱਲਦੀਆਂ ਹਨ ਇਸ ਤੋਂ ਇਲਾਵਾ ਟੈਕਸੀਆਂ ਅਤੇ ਕਾਰਾਂ ਅਤੇ ਇਸ ਤੋਂ ਇਲਾਵਾ ਆਟੋ ਰਿਕਸ਼ਾ ਵੀ ਅਵੇ ਉਪਲੱਬਧ ਹਨ ਜੋ ਕਿ ਸੈਲਾਨੀਆਂ ਲਈ ਖਿੱਚ ਦਾ ਕਾਰਨ ਬਣਦੇ ਹਨ ਦੂਸਰੀ ਗੱਲ ਇਹ ਹੈ ਕਿ ਇਹ ਕਾਫ਼ੀ ਤਰ੍ਹਾਂ ਨਾਲ ਭਰੋਸੇਮੰਦ ਹੁੰਦੀਆਂ ਹਨ ਅਤੇ ਸੈਲਾਨੀਆਂ ਅੱਖਾਂ ਮੀਚ ਕੇ ਇਸ 'ਤੇ ਭਰੋਸਾ ਕਰ ਸਕਦੇ ਹਨ ਅਤੇ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਠੱਗੀ ਜਾਂ ਚੋਰੀ ਨਹੀਂ ਹੁੰਦੀ ਹੈ ਇਸ ਕਾਰਨ ਕਰਕੇ ਪੰਜਾਬ ਵਿੱਚ ਕਈ ਤਰ੍ਹਾਂ ਦੇ ਆਟੋ ਰਿਕਸ਼ਾ ਅਵੀਲ ਕਰਨਾ